ਸਤਿ ਸ਼੍ਰੀ ਅਕਾਲ ਜੀ ਹਾਂਜੀ

ਅਤੇ ਇਹਦੇ ਲਈ ਤੁਹਾਡੇ ਇੰਟਰਸਟ ਅਤੇ ਹੈਗਾ ਵੀ ਤੁਹਾਡਾ ਇੰਟਰਸਟ ਕਿਹੜੀ ਸਟਰੀਮ 'ਚ ਹੈਗਾ ਜਾਂ ਬਾਕੀ ਐਵੇਂ ਵੀ ਹੋ ਸਕਦਾ ਜੇ ਤੁਸੀਂ ਬੀ ਏ ਕੀਤੀ ਹੈ ਤਾਂ ਉਹਦੇ ਨਾਲ ਤੁਸੀਂ ਈ ਟੀ ਟੀ ਐਨ ਟੀ ਟੀ ਇਹ ਸਭ ਕੋਰਸ ਕਰਕੇ ਤੁਸੀਂ ਪੇਪਰ ਕਲੀਅਰ ਕਰਕੇ ਉੱਦੂ ਬਾਅਦ ਗੌਰਮੈਂਟ ਜੋਬ ਜਿਹੜੀ ਹੈਗੀ ਆ ਲੈ ਸਕਦੇ ਹੋ ਇੱਦੂ ਇਲਾਵਾ ਹੋਰ ਵੀ ਕਈ ਪੇਪਰ ਹੈ ਜਿਵੇਂ ਹੋ ਗਏ ਰੇਲਵੇ ਦੇ ਰੇਲਵੇ ਦੇ ਪੋਸਟਾਂ ਅਤੇ ਪੋਸਟ ਔਫਿਸ ਦੇ ਪੇਪਰ ਕਲੀਅਰ ਕਰੋ ਠੀਕ ਆ ਅਤੇ ਉਹਦੀਆਂ ਪੋਸਟਾਂ ਭਰੋ ਠੀਕ ਹੈ ਅਤੇ ਹੋਰ ਕਈ ਹੈਗੇ ਆ ਜਿਵੇਂ ਆਈ ਸੀ ਆਈ ਆਈ ਟੀ ਆਈ ਡਿਵਲਪਮੈਂਟ 'ਚ ਟੀਚਰ ਦਾ ਠੀਕ ਹੈ ਉੱਥੇ ਵੀ ਉੱਥੇ ਵੀ ਅਲੱਗ ਅਲੱਗ ਆਉਂਦੀ ਰਹਿੰਦੀਆਂ ਪੋਸਟਾਂ ਜਿਵੇਂ ਤੁਸੀਂ ਉਹ ਭਰਦੇ ਰਿਹਾ ਕਰੋ ਠੀਕ ਹੈ ਅਤੇ ਹੋਰ ਬਾਕੀ ਤੁਸੀਂ ਤੁਹਾਨੂੰ ਮੈਂ ਦੱਸਿਆ ਜਿਵੇਂ ਬੀ ਏ ਕਰਕੇ ਈ ਟੀ ਟੀ ਐਨ ਟੀ ਟੀ ਵਰਗੇ ਕੋਰਸ ਕਰਕੇ ਜੇ ਤਾਂ ਜੇ ਤੁਸੀਂ ਨਰਸ ਆਦਿ ਜਾਂ ਹੋਰ ਵੀ ਕਰਨਾ ਠੀਕ ਹੈ ਫਿਰ ਉਹਦੇ ਲਈ ਤੁਸੀਂ ਜੀ ਐਨ ਐਮ ਠੀਕ ਹੈ ਏ ਐਨ ਐਮ ਵੀ ਕਰ ਸਕਦੇ ਹੋ ਠੀਕ ਹੈ ਅਤੇ ਠੀਕ ਹੈ ਅਤੇ ਹੋਰ ਕੁਛ

ਠੀਕ ਹੈ ਜੀ ਠੀਕ ਆ ਜੀ ਵੈਲਕਮ ਵੈਲਕਮ